ਹੈਲੋ ਹਾਂ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਰ ਤੁਸੀਂ ਨਵਾਂ ਸ਼ਹਿਰ ਡਿਸਟਿਕ ਤੋਂ ਬੋਲ ਰਹੇ ਹੋ ਹਾਂਜੀ ਸਰ ਆਪਾਂ ਮੈਂ ਮੀਡੀਆ ਤੋਂ ਬੋਲ ਰਹੇ ਹਾਂ ਅਤੇ ਆਪਾਂ ਡਿਸਟਰਿਕ ਵਾਈਜ਼ ਨਾ ਇੱਕ ਸਰਵੇ ਕਰ ਰਹੇ ਹਾਂ ਜਿਹਦੇ 'ਤੇ ਰਿਪੋਰਟ ਤਿਆਰ ਕਰਨੀ ਆ ਆਪਾਂ ਅਤੇ ਇੱਕ ਆਪਾਂ ਸਰਵੇ ਕਰ ਰਹੇ ਹਾਂ ਕਿ ਇੱਥੋਂ ਦੀ ਕਿਵੇਂ ਚੱਲ ਰਿਹਾ ਪ੍ਰੋਸੈਸ ਲੋਕਲ ਗਵਰਮੈਂਟ ਨੇ ਕੀ ਕੀ ਡਿਵਲਪਮੈਂਟ ਕੀਤੀ ਹੈ ਸਾਨੂੰ ਦੱਸ ਸਕਦੇ ਓਂ ਹਾਂਜੀ ਹਾਂਜੀ ਸਰ ਸ਼ੋਟ 'ਚ ਦੱਸ ਦਿਉ ਸਾਨੂੰ ਹਾਂਜੀ

ਠੀਕ ਠੀਕ ਹੈ ਸਰ ਚਲੋ ਜੇ ਸਾਨੂੰ ਹੋਰ ਇਨਫੋਰਮੇਸ਼ਨ ਦੀ ਲੋੜ ਹੋਈ ਆਪਾਂ ਕਾਲ ਕਰ ਲਵਾਂਗੇ ਤੁਹਾਨੂੰ ਓਕੇ ਸਰ